ਸਾਡੇ ਪੰਜਾਬ ਸੂਬੇ ਦੇ ਵਿੱਚ ਪੰਜਾਬੀ ਵਿਰਾਸਤ ਜਿਹੜੀ ਬੜੀ ਅਮੀਰ ਹੈ ਇਹਨੂੰ ਸੰਭਾਲਣ ਲਈ ਅਸੀਂ ਪੰਜਾਬੀ ਭਾਸ਼ਾ ਨੂੰ ਅੱਗੇ ਲਿਆ ਕੇ ਇਹ ਤੋਂ ਸਿੱਖ ਕੇ ਬੜਾ ਕੁਝ ਕਿਉਂਕਿ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਅਮੀਰ ਸ਼ਬਦ ਹੈ ਅਤੇ ਬਹੁਤ ਸਾਰੀ ਸਾਡੀ ਵਿਰਾਸਤ ਬੜੀ ਅਮੀਰ ਹੈ ਉਹਨੂੰ ਅਸੀਂ ਸੰਭਾਲਣ ਵਾਸਤੇ ਦਿਨ ਰਾਤ ਪੰਜਾਬੀ ਭਾਸ਼ਾ ਦੇ ਨਾਲ ਰਲਕੇ ਉਪਰਾਲਾ ਕਰ ਰਹੇ ਹਾਂ